ਪੰਜਾਬ ਵਿੱਚ ਖੇਡ ਖੇਤਰ ਤੇ ਖੇਡਾਂ ਨੂੰ ਲੈ ਕੇ ਇਹਨਾਂ ਸਬੰਧਿਤ ਭ੍ਰਿਸ਼ਟਾਚਾਰ ਜਾਂ ਖਿਡਾਰੀਆਂ ਪ੍ਰਤੀ ਦੁਰਵਿਵਹਾਰ ਦੇ ਮੁੱਦਿਆਂ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਹੱਲ ਕੀਤਾ ਜਾਂਦਾ ਹੈ ਜਿਵੇਂ ਕਿ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਕਮੇਟੀਆਂ ਅਤੇ ਬਹੁਤ ਸਾਰੀਆਂ ਜਾਂਚ ਕਮੇਟੀਆਂ ਬੈਠਾਈਆਂ ਹਨ ਨਿਯੁਕਤ ਕੀਤੀਆਂ ਗਈਆਂ ਹਨ ਜਿਹਨਾਂ ਦੁਆਰਾ ਖਿਡਾਰੀਆਂ ਦੇ ਹੋਰ ਜਿਹੜੇ ਇੱਥੇ ਚਲਾਏ ਜਾ ਰਹੇ ਇੰਸਟੀਚਿਊਟ ਉਨ੍ਹਾਂ ਦਾ ਜਿਹੜਾ ਅ ਇੰਸਪੈਕਸ਼ਨ ਅਤੇ ਜਾਂਚ ਵੀ ਕੀਤੀ ਜਾਂਦੀ ਹੈ ਅਤੇ ਇਸ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਹੱਲ ਕਰਨ ਵਾਸਤੇ ਸਰਕਾਰ ਨੇ ਇੱਕ ਐਪਲੀਕੇਸ਼ਨ ਵੀ ਚਲਾਈ ਹੈ ਜਿਸ ਦੇ ਵਿਚ ਖਿਡਾਰੀ ਆਪਣਾ ਰੇਵਿਊ ਦੇ ਕੇ ਉਸ ਦੇ ਵਿੱਚ ਆਪਣੀ ਆਉਣ ਵਾਲੀ ਮੁਸੀਬਤ ਜਾਂ ਕੋਈ ਉਹਨਾਂ ਨੂੰ ਤੰਗ ਕਰ ਰਿਹਾ ਹੈ ਜਾਂ ਕਿਸੇ ਝੂਠੇ ਇਲਜ਼ਾਮ ਦੇ ਵਿੱਚ ਫਸਾਉਣਾ ਚਾਹੁੰਦਾ ਹੈ ਉਸ ਨੂੰ ਲੈ ਕੇ ਉਸ ਨੂੰ ਹੱਲ ਕਰ ਸਕਦੇ ਹਨ ਸੰਸ ਅ ਸਰਕਾਰ ਨੇ ਅ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੀ ਖੋਲ੍ਹੀ ਹੋਈ ਹੈ ਜਿਸ ਦੇ ਵਿੱਚ ਸਰਕਾ ਅ ਖਿਡਾਰੀ ਆਪਣੇ ਆਪ ਨੂੰ ਟੈਲੇਂਟਿਡ ਨੂੰ ਆਪਣੇ ਨੂੰ ਪ੍ਰਮੋਟ ਕਰਕੇ ਅ ਬਹੁਤ ਸਾਰੇ ਆਪਣੇ ਆਪਣਾ ਨਾਮ ਕਮਾ ਸਕਦੇ ਹਨ ਅਤੇ ਇਨ੍ਹਾਂ ਦੁਆਰਾ ਦੁਰਵਿਵਹਾਰ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਤੋਂ ਬਚ ਸਕਦੇ ਹਨ ਸੋ ਇਹ ਇਨ੍ਹਾਂ ਦੇ ਅ ਮੁੱਦੇ ਨੂੰ ਲੈ ਕੇ ਹੱਲ ਕਰਨ ਵਾਸਤੇ ਸਰਕਾਰ ਨੇ ਬਹੁਤ ਸਾਰੇ ਕਦਮ ਵੀ ਚੁੱਕੇ ਹਨ ਅਤੇ ਆਪਣੇ ਬਹੁਤ ਸਾਰੇ ਗੁਪਤ ਬੰਦੇ ਵੀ ਭੇਜੇ ਹੋਏ ਹਨ